ਮੈਂ ਰਾਜਕੁਮਾਰ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਅੱਜ ਕੁੱਕਰ ਬਾਰੇ ਦੱਸਿਆ ਗਿਆ ਹੈ ਕਿ ਕੁੱਕਰ ਦੀ ਵਰਤੋਂ ਆਮ ਹੋ ਗਈ ਹੈ ਜਿਵੇਂ ਕਿ ਰੈਸਟੋਰੈਂਟ ਵਿੱਚ ਢਾਬਿਆਂ 'ਚ ਵਿਆਹਾਂ ਸ਼ਾਦੀਆਂ ਵਿੱਚ ਅਤੇ ਘਰਾਂ ਵਿੱਚ ਲੋਕ ਕੁੱਕਰ ਦੀ ਵਰਤੋਂ ਜ਼ਿਆਦਾ ਕਰਦੇ ਹੈ ਕਿਉਂ ਕਿਉਂਕਿ ਕੁੱਕਰ ਵਿੱਚ ਜਲਦੀ ਖਾਣਾ ਤਿਆਰ ਹੁੰਦਾ ਹੈ ਅਤੇ ਟੈਮ ਦੀ ਬੱਚਤ ਹੁੰਦੀ ਹੈ ਇਸ ਕਰਕੇ ਲੋਕੀ ਕੁੱਕਰ ਨੂੰ ਵਰਤਣ ਲੱਗ ਪਏ ਪਰ ਇੱਕ ਪਾਸੇ ਵੇਖਿਆ ਜਾਵੇ ਤਾਂ ਜੋ ਪਹਿਲੇ ਯੁੱਗ ਵਿੱਚ ਮਿੱਟੀ ਦੇ ਬਰਤਨਾਂ ਵਿੱਚ ਕੋਈ ਵੀ ਭੋਜਨ ਅਸੀਂ ਤਿਆਰ ਕਰਦੇ ਸਾਂ ਤਾਂ ਉਸ ਦੀ ਮਤਲਬ ਵੀ ਸਵਾਦਿਸ਼ਟ ਬਣਦਾ ਸੀ ਜੋ ਚੀਜ਼ ਅੱਜ ਦੇ ਜਮਾਨੇ ਵਿੱਚ ਨਹੀਂ ਰਹੀ ਪਰ ਕੁਛ ਟਾਈਮ ਬਾਅਦ ਇਹ ਮਿੱਟੀ ਦੇ ਬਰਤਨ ਦੁਬਾਰਾ ਸਾਡੀ ਜੀਵਨ ਵਿੱਚ ਜ਼ਰੂਰ ਆਉਣਗੇ ਜੇ ਕੋਈ ਆਮ ਲੋਕ ਵਿਆਹਾਂ ਸ਼ਾਦੀਆਂ ਵਿੱਚ ਵੀ ਕੁੜੀ ਨੂੰ ਕੁੱਕਰ ਜ਼ਰੂਰ ਦੇਣਗੇ ਜਦੋਂ ਕਿ ਸਾਡੇ ਆਪਣੇ ਘਰਾਂ ਵਿੱਚ ਵੀ ਕੁੱਕਰ ਦੀ ਵਰਤੋਂ ਜ਼ਿਆਦਾ ਹੋਣ ਲੱਗ ਪਈ ਜਿਹਦੇ ਕਾਰਨ ਬਿਮਾਰੀਆਂ ਕਾਫੀ ਕੁਛ ਹੋ ਰਿਹਾ ਹੈ ਜਿਵੇਂ ਕਿ ਅਸੀਂ ਕੁੱਕਰ ਦਾ ਖਾਣਾ ਖਾਂਦੇ ਹਾਂ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਉਹ ਜ਼ਿਆਦਾ ਹੋ ਰਿਹਾ ਜਦੋਂ ਕਿ ਪਹਿਲੇ ਬਰਤਨਾਂ ਵਿੱਚ ਪੱਕਿਆ ਹੋਇਆ ਭੋਜਨ ਜੋ ਕਿ ਅੱਛੀ ਤਰ੍ਹਾਂ ਰਿੱਝਦਾ ਸੀ ਅਗਰ ਚੁੱਲੇ 'ਤੇ ਬਣਿਆ ਉਹ ਸਵਾਦਿਸ਼ਟ ਹੁੰਦਾ ਸੀ ਪਰ ਹੁਣ ਉਹ ਜਮਾਨਾ ਨਹੀਂ ਰਿਹਾ ਜਿਵੇਂ ਜਿਵੇਂ ਲੋਕ ਬਦਲ ਰਹੇ ਹੈ ਉਦਾਂ ਉਦਾਂ ਲੋਕ ਤਕਨੀਕ ਵੀ ਬਦਲ ਰਹੀ ਹੈ ਪਰ ਆਉਣ ਵਾਲਾ ਯੁੱਗ ਜੋ ਹੈ ਮਿੱਟੀ ਦੇ ਭਾਂਡਿਆਂ ਵਿੱਚ ਹੀ ਖਾਣਾ ਜਿਹੜਾ ਪੱਕਿਆ ਹੁੰਦਾ ਉਹ ਹੀ ਫਾਇਦੇਮੰਦ ਹੁੰਦਾ ਹੈ